ਗ੍ਰਹਿ ਤੋਂ ਜੀਵਨ ਬਾਰੇ ਜੋ ਹੁਣ ਸੁਣ ਰਹੇ ਅੱਜ ਕੱਲ੍ਹ ਸੁਣ ਹੀ ਰਹੇ ਹੈ ਕੋਈ ਜੋ ਗ੍ਰਹਿਆਂ ਦੇ ਵਿੱਚ ਅਜੇ ਤੱਕ ਕੋਈ ਵਿਸ਼ਵਾਸ ਹੋਰ ਪੂਰਨ ਤੌਰ 'ਤੇ ਬੰਦਾ ਕੋਈ ਗ੍ਰਹਿ ਨੂੰ ਨਾ ਤਾਂ ਕੋਈ ਪਾ ਸਕਿਆ ਨਾ ਹੀ ਪਾਊਗਾ ਕਿਉਂਕਿ ਸਿਸਟਮ ਇੱਕ ਇੱਕ ਗੁਰੂ ਮਹਾਰਾਜ ਦਾ ਇੰਨਾ ਸਿਸਟਮ ਬਣਾਇਆ ਹੋਇਆ ਜਿਹਦੇ 'ਚ ਵਿਗਿਆਨੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਗ੍ਰਹਿ ਗਰੂਆਂ 'ਤੇ ਪੂਰਨ ਉਤਰ ਨਹੀਂ ਸਕਦੇ ਠੀਕ ਆ ਉਹਦਾ ਦਾਰੋ ਮਦਾਰ ਚਲਾਈ ਜਾਂਦੇ ਆ ਪਰ ਫਿਰ ਵੀ ਟਾਈਮ ਪਤਾ ਨਹੀਂ ਕਿੰਨਾ ਲੱਗੇ ਕਿੰਨਾ ਨਾ ਅੱਗੇ ਪਰ ਫਿਰ ਵੀ ਇਹਨਾਂ ਨੂੰ ਪੂਰਨ ਤੌਰ 'ਤੇ ਆਪਣੇ ਗਿਆਨ ਦੇ ਵਿੱਚ ਲਿਆਉਣਾ ਜਾਂ ਲੋਕਾਂ ਨੂੰ ਵਿਸ਼ਵਾਸ ਦੇਣਾ ਲੋਕਾਂ ਨੂੰ ਇਹਨੂੰ ਜਾਗਰੂਕ ਕਰਨਾ ਮਤਲਬ ਬਹੁਤ ਔਖਾ ਕੰਮ ਹੈ ਇਹ ਕੋਈ ਆਮ ਵਧੀਆ ਨਹੀਂ ਆ ਵੀ ਮਤਲਬ ਇੰਨੀ ਜਲਦੀ ਆਪਾਂ ਇਸ ਨੂੰ ਪੂਰਨ ਤੌਰ 'ਤੇ ਆਪਾਂ ਇਹਨੂੰ ਮਿਸਾਲ ਤੌਰ 'ਤੇ ਆਪਾਂ ਇਹਨੂੰ ਪੂਰਨ ਵਧੀਆ ਆਪਾਂ ਦੇਖ ਸਕਦੇ ਜਾਂ ਲੋਕਾਂ ਨੂੰ ਵਿਸ਼ਵਾਸ ਦਵਾ ਸਕਦੇ ਹਾਂ ਇਹ ਸਿਰਫ਼ ਕਹਿਣ ਕੂਣ ਦੀਆਂ ਗੱਲਾਂ ਹੀ ਆ ਸਿਰਫ਼ ਐਵੇਂ ਮਤਲਬ ਕਹਿਣ ਦੀਆਂ ਗੱਲਾਂ ਬਾਕੀ ਇਹ ਦਿਲ ਦਾ ਸ਼ਾਂਤ ਪੂਰਾ ਨਹੀਂ ਨਾ ਹੀ ਹੋ ਹੋ ਹੋ ਸਕਦਾ ਹੁਣ ਤੱਕ ਤਾਂ ਹੋ ਨਹੀਂ ਸਕਦਾ ਬਾਕੀ ਕਿੰਨਾ ਟਾਈਮ ਲੱਗੇ ਕਿੰਨਾ ਨਾ ਲੱਗੇ ਉਹ ਬਾਅਦ ਦੀ ਗੱਲ ਆ